ਪੰਜ ਲੱਖ ਪਚਵੰਜਾ ਹਜ਼ਾਰ ਪੰਜ ਸੌ ਬਾਈ ਦੋ ਲੱਖ ਦੋ ਹਜ਼ਾਰ ਦੋ ਸੌ ਇੱਕੀ ਇੱਕ ਲੱਖ ਗਿਆਰ੍ਹਾਂ ਹਜ਼ਾਰ ਇੱਕਵੰਜਾ ਸੌ ਪੰਜ ਸੌ ਬਾਈ